ਹੈਲੋ ਹੈਲੋ ਜਸਲੀਨ ਕਿਵੇਂ ਆ ਕਿੱਥੇ ਨਹੀਂ ਮੈਂ ਤਾਂ ਥੱਕੀ ਆ ਰਹੀ ਹਾਂ ਔਫਿਸ ਤੋਂ ਹੁਣੇ ਆਈ ਹਾਂ ਰੋਜ਼ ਰੋਜ਼ ਔਫਿਸ ਜਾ ਕੇ ਯਾਰ ਥੱਕ ਜਾਂਦੀ ਆ ਕੰਮ ਕਰ ਕਰ ਕੇ ਮੈਂ ਸੋਚ ਰਹੀ ਹਾਂ ਆਪਾਂ ਆਪਣਾ ਹੀ ਇੱਕ ਸਟਾਰਟ ਅਪ ਸ਼ੁਰੂ ਕਰ ਲਈਏ ਆਪਾਂ ਨਾ ਇਹ ਕੰਪਨੀ ਖੋਲ੍ਹਦੇ ਹਾਂ ਕੰਪਨੀ ਵਿੱਚ ਆਪਾਂ ਡੇਢ ਮਹੀਨੇ ਦੇ ਜੋ ਛੇ ਮਹੀਨੇ ਦੀ ਇੰਜੀਨੀਅਰਿੰਗ ਦੀ ਜੋ ਪਲੇਸਮੈਂਟ ਲਈ ਬੱਚੇ ਲੈਂਦੇ ਆ ਨਾ ਟ੍ਰੇਨਿੰਗ ਉਹ ਆਪਾਂ ਦਿਆ ਕਰਾਂਗੇ ਉਹਦੇ ਆਪਾਂ ਚਾਰਜਿਸ ਲਿਆ ਕਰਾਂਗੇ ਉਹਦੇ 'ਚ ਨਾ ਆਪਾਂ ਕੀ ਕਰਿਆ ਕਰਾਂਗੇ ਜੋ ਛੇ ਸਾਲ ਛੇ ਮਹੀਨੇ ਦੀ ਟ੍ਰੇਨਿੰਗ ਲਈ ਬੱਚੇ ਆਉਂਦੇ ਆ ਉਹਨਾਂ ਤੋਂ ਆਪਾਂ ਇੱਕ ਬੋਲਡ ਸਾਈਨ ਕਰਾ ਲਾਂਗੇ ਕਿ ਤੁਸੀਂ ਚਾਲ੍ਹੀ ਵੀਹ ਹਜ਼ਾਰ ਰੁਪਏ ਦਿਓ ਅਤੇ ਸਾਡੇ ਤੋਂ ਪਲੇਸਮੈਂਟ ਲਈ ਤਿਆਰੀ ਕਰਾਓ ਤੋ ਜੇ ਤੁਸੀਂ ਤੁਹਾਡੀ ਪੱਕੀ ਪੱਕੀ ਪਲੇਸਮੈਂਟ ਕਰਾਉਣੀ ਹੀ ਕਰਾਉਣੀ ਹੈਗੀ ਆ ਉਸ ਕੰਪਨੀ 'ਚ ਇਨ ਕੇਸ ਜੇ ਉਹ ਸਾਡੀ ਕਰਕੇ ਛੱਡ ਕੇ ਚਲੇ ਜਾਂਦੇ ਆ ਨਾ ਦੂਜੀ ਕੰਪਨੀ ਚਲੇ ਜਾਂਦੇ ਆ ਤੋ ਉਹਨਾਂ ਨੂੰ ਸਾਨੂੰ ਪੈਸੇ ਭਰਨੇ ਆਉਗੇ ਹਾਂ ਬਿਲਕੁਲ ਹੁਣ ਨਾ ਅਗਲੀ ਵਾਰ ਮਿਲ ਕੇ ਵਿਚਾਰ ਕਰਾਂਗੇ ਠੀਕ ਹੈ ਹੁਣ ਨਾ ਮੈਨੂੰ ਮੇਰੇ ਕੰਮ ਹੈਗੇ ਮੈਂ ਕਰਦੀ ਹੈ ਤੈਨੂੰ ਫੋਨ ਬਾਏ